ਚਿੱਤਰਕਾਰੀ ਇੱਕ ਕਲਾ ਹੈ ਅਤੇ ਆਪਣੇ ਭਾਵਾਂ ਅਤੇ ਆਪਣੇ ਅਨੁਭਵ ਨੂੰ ਚਿੱਤਰਕਾਰੀ ਵਿੱਚ ਬਦਲਣਾ ਵੀ ਇੱਕ ਕਲਾ ਹੈ ਇੱਕ ਮਨੁੱਖ ਜੋ ਇੱਕ ਮਨੁੱਖ ਦੇ ਦਿਨ ਦੇ ਵਿੱਚ ਹਜ਼ਾਰਾਂ ਖਿਆਲ ਆਉਂਦੇ ਨੇ ਅਤੇ ਉਹ ਉਹ ਖਿਆਲਾਂ ਦੇ ਵਿੱਚ ਉਹ ਇੱਕ ਆਪਣੀ ਇੱਕ ਅਲੱਗ ਦੁਨੀਆ ਬਣਾਉਂਦਾ ਹੈ ਅਤੇ ਉਹ ਹੀ ਦੁਨੀਆ ਦੁਨੀਆ ਬਾਰੇ ਸੋਚ ਕੇ ਉਹ ਚਿੱਤਰਕਾਰੀ ਕਰ ਸਕਦਾ ਹੈ ਅਤੇ ਉਹ ਕਰਦਾ ਵੀ ਹੈ ਕਈ ਵਾਰ ਉਹ ਆਪਣੇ ਭਾਵ ਐਂ ਵਧੀਆ ਤਰੀਕੇ ਨਾਲ ਪ੍ਰਗਟ ਕਰਦਾ ਹੈ ਜਿਸ ਵਿੱਚ ਕਈ ਵਾਰ ਉਹ ਕੁਛ ਬਣਾਉਣਾ ਕੁਛ ਚਾਹੁੰਦਾ ਹੈ ਅਤੇ ਬਣਾ ਕਦੇ ਕੁਛ ਹੋਰ ਦਿੰਦਾ ਹੈ ਜਿਵੇਂ ਜਿਵੇਂ ਕਿ ਮੈਂ ਇੱਕ ਵਾਰ ਇੱਕ ਪੇਂਟਿੰਗ ਬਣਾਈ ਬਣਾਉਣਾ ਚਾਹ ਰਹੀ ਸੀ ਇੱਕ ਔਰਤ ਦੀ ਜਿਸ ਵਿੱਚ ਉਹ ਆਪਣਾ ਕੰਮ ਕਰ ਰਹੀ ਹੈ ਅਤੇ ਬਣਾਂ ਬਣਾਉਂਦੇ ਵਕਤ ਮੈਨੂੰ ਇੰਨਾ ਕੁਛ ਸੋਚਿਆ ਨਹੀਂ ਸੀ ਜਦੋਂ ਲੇਕਿਨ ਜਦੋਂ ਬਣਾਉਣ ਤੋਂ ਬਾਅਦ ਉਨ ਉਸ ਨੂੰ ਦੇਖਣ ਤੋਂ ਬਾਅਦ ਐਂ ਦਿਖਿਆ ਕਿ ਉਹ ਉਸ ਪੇਂਟਿੰਗ 'ਚੋਂ ਮੈਨੂੰ ਕੋਈ ਇੱਕ ਵਧੀਆ ਊਰਜਾ ਮਿਲ ਰਹੀ ਹੈ ਇੱਕ ਉਤਸ਼ਾਹ ਮਿਲ ਰਿਹਾ ਹੈ ਉਦ ਉਸਦੇ ਉਸਦੇ ਐਕਸਪ੍ਰੈਸ਼ਨ ਉਸਦੇ ਉਸ ਜੋ ਚਿੱਤਰਕਾਰੀ ਵਿੱਚ ਉਸਦੇ ਐਕਸਪ੍ਰੈਸ਼ਨ ਸੀ ਉਸ ਦੇ ਨਾਲ ਇਹ ਸਾਫ਼ ਦਿਖ ਰਿਹਾ ਸੀ ਕਿ ਉਹ ਕਿਵੇਂ ਆਪਣੀ ਮੁਸੀਬਤਾਂ ਨਾਲ ਲੜ ਰਹੀ ਹੈ ਅਤੇ ਬਹਾਦਰੀ ਦੀ ਜਿਹੜੀ ਝਲਕ ਹੈ ਉਸ ਚਿੱਤਰਕਾਰੀ ਵਿੱਚੋਂ ਦਿਖ ਰਹੀ ਸੀ ਜਿਹੜੇ ਆਪਣੇ ਇਮੋਸ਼ਨਜ ਹੈ ਆਪਣੇ ਜਿਹੜੇ ਭਾਵ ਹੈ ਉਨ ਆਪਣੇ ਜਿਹੜੇ ਆਪਣੇ ਜਿਹੜੇ ਆਹਾ ਨਿੱਜੀ ਅਨੁਭਵ ਹੈ ਉਹ ਚਿੱਤਰਕਾਰੀ ਵਿੱਚ ਬਹੁਤ ਮਹੱਤਤਾ ਰੱਖਦੇ ਹਨ ਇੱਕ ਜਿਹੜਾ ਕਲਾਕਾਰ ਹੁੰਦਾ ਹੈ ਉਹ ਆਪਣੇ ਜਿਹੜੇ ਭਾਵ ਹੈ ਉਹ ਆਪਣੇ ਚਿੱਤਰਕਾਰੀ ਦੁਆਰਾ ਦੂਜਿਆਂ ਨੂੰ ਦਰਸਾਉਂਦਾ ਹੈ ਅਤੇ ਉਸਦੇ ਨਿੱਜੀ ਜੀਵਨ ਵਿੱਚ ਜਿਵੇਂ ਕੁਝ ਆਹ ਕੁਛ ਵੀ ਹੋਰ ਹੈ ਜਿਵੇਂ ਉਹਦੇ ਉਹਦੇ ਜਿੱਥੇ ਉਹ ਰਹਿ ਰਿਹਾ ਹੈ ਉੱਥੇ ਕੋਈ ਗਰੀਬੀ ਜ਼ਿਆਦਾ ਹੈ ਉੱਥੇ ਕੋਈ ਪਾਣੀ ਦੀ ਘਾਟ ਹੈ ਉਹ ਉਹ ਆਪਣੇ ਉਹ ਜਿਹੜੀ ਉਹਦੇ ਲਾਈਫ ਐਕਸਪੀਰੀਅੰਸ ਹੈ ਉਹ ਆਪਣੇ ਆਰਟ ਦੀ ਫੋਮ ਆਪਣੀ ਕਲਾ ਦੇ ਫੋਮ ਵਿੱਚ ਉਹ ਕਨਵਰਟ ਕਰਦਾ ਹੈ ਅਤੇ ਦੂਜਿਆਂ ਨੂੰ ਪ੍ਰਗਟ ਕਰਦਾ ਹੈ ਅਤੇ ਦੂਜਿਆਂ ਨੂੰ ਵੀ ਉਹ ਚਿੱਤਰ ਚਿੱਤਰਕਾਰੀ ਦੇਖ ਕੇ ਜਾਂ ਕਲਾ ਦੇਖ ਕੇ ਇੱਕ ਉਹਨਾਂ ਨੂੰ ਉਹਨਾਂ ਦੇ ਵਿੱਚ ਵੀ ਜਾਗਰੂਕਤਾ ਫੈਲਦੀ ਹੈ ਕਿ ਇਹ ਵੀ ਸਮਾਜ ਦੇ ਵਿੱਚ ਕੁਛ ਇਹੋ ਜਿਹੀਆਂ ਦਿੱਕਤਾਂ ਨੇ ਜਿਹਨਾਂ ਉੱਤੇ ਕੰਮ ਕੀਤਾ ਜਾਣਾ ਚਾਹੀਦਾ ਹੈ ਇਸ ਲਈ ਜਿਹੜੇ ਆਪਣੇ ਆਹਾ ਨਿੱਜੀ ਅਨੁਭਵ ਹੈ ਜਾਂ ਜਿਹੜੇ ਇਮੋਸ਼ਨਜ ਹੈ ਆਪਣੀ ਭਾਵਨਾਵਾਂ ਹੈ ਉਹਨਾਂ ਨੂੰ ਇੱਕ ਆਹਾ ਚਿੱਤਰ ਦੇ ਵਿੱਚ ਕਨਵਰਟ ਕਰਨਾ ਉਹ ਵੀ ਇੱਕ ਕਲਾ ਹੈ ਉਹ ਆਪਣੇ ਆਪ ਵਿੱਚ ਇੱਕ ਇੱਕ ਕਲਾ ਹੈ ਅਤੇ ਆਪਾਂ ਇਸ ਕਲਾ ਨੂੰ ਸਿੱਖ ਵੀ ਸਕਦੇ ਹਾਂ ਆਪਾਂ ਜਿਵੇਂ ਰੋਜ਼ ਰੋਜ਼ ਕਦੇ ਨਾ ਕਦੇ ਜ ਜਦੋਂ ਆਪਣੇ ਜਦੋਂ ਆਪਾਂ ਬਹੁਤ ਜ਼ਿਆਦਾ ਸੋਚਣ ਬੈਠ ਜਾਂਦੇ ਹਾਂ ਆਪਾਂ ਨੂੰ ਕਈ ਵਾਰ ਪਤਾ ਵੀ ਨਹੀਂ ਲੱਗਦਾ ਕਿ ਆਪਾਂ ਕਿਆ ਕੁਛ ਸੋਚਦੇ ਰਹਿੰਦੇ ਹਾਂ ਲੇਕਿਨ ਜਦ ਆਪਾਂ ਇੰਨਾ ਕੁਛ ਸੋਚਦੇ ਹਾਂ ਆਪਾਂ ਇੱਕ ਪੇਪਰ ਜਾਂ ਇੱਕ ਪੈਨ ਲੈ ਕੇ ਪੇਪਰ ਪੈਨ ਲੈ ਕੇ ਆਪਾਂ ਨੂੰ ਬੈਠ ਜਾਣਾ ਚਾਹੀਦਾ ਹੈ ਅਤੇ ਜੋ ਸੋਚਦੇ ਹਾਂ ਉਹਨੂੰ ਇੱਕ ਆਹਾ ਫੋਰਮ ਇੱਕ ਸ਼ੇਪ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਵੇਂ ਜਿਵੇਂ ਆਪਾਂ ਇਸ ਕਲਾ ਨੂੰ ਪ੍ਰੈਕਟਿਸ ਕਰਦੇ ਜਾਵਾਂਗੇ ਆਪਾਂ ਇਸ ਵਿੱਚ ਵਧੀਆ ਕਰਦੇ ਜਾਵਾਂਗੇ ਇਸ ਲਈ ਜਿਹੜੀ ਚਿੱਤਰਕਾਰੀ ਹੈ ਉਹ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੁੰਦੀ ਹੈ ਜਿਹੜੀ ਕਿ ਦੂ ਦੂਜਿਆਂ ਸਾਹਮਣੇ ਆਪਣੇ ਭਾਵ ਪ੍ਰਗਟ ਕਰ ਸਕੇ